ਹਾਈਕ ਕਰਨ ਲਈ ਮੈਨੂੰ ਜ਼ਿਆਦਾਤਰ ਬਰਫੀਲੇ ਪਹਾੜ ਵਧੀਆ ਲੱਗਦੇ ਹਨ ਅਤੇ ਜਿਹੜਾ ਸੂਰਜ ਡੁੱਬਣਾ ਹੈ ਉਹ ਵੀ ਮੈਨੂੰ ਬਹੁਤ ਜ਼ਿਆਦਾ ਪਸੰਦ